ਹਾਂਜੀ ਬਿਲਕੁਲ ਅਸੀਂ ਇੱਕ ਵੱਖਰੀ ਭਾਸ਼ਾ ਅਤੇ ਸੱਭਿਆ ਬਾਰੇ ਸੱਭਿਆਚਾਰ ਵਾਲੀ ਜਗ੍ਹਾ 'ਤੇ ਯਾਤਰਾ ਕੀਤੀ ਹੈ ਅਤੇ ਉੱਥੋਂ ਜਾ ਕੇ ਸਾਨੂੰ ਵੱਖਰਾ ਹੀ ਉਥੋਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਨੂੰ ਮਿਲਿਆ ਸੀ ਪਰ ਸਾਨੂੰ ਉੱਥੋਂ ਬਹੁਤ ਮਜ਼ਾ ਵੀ ਆਇਆ ਕਿ ਅਸੀਂ ਦੂਜੇ ਵੱਖ ਵੱਖ ਤਰ੍ਹਾਂ ਦੇ ਲੋਕਾਂ ਨਾਲ ਉੱਥੇ ਵਿਚਰੇ ਅਤੇ ਸਾਨੂੰ ਉਹਨਾਂ ਦੇ ਕਲਚਰ ਦਾ ਸੱਭਿਆਚਾਰ ਦਾ ਉਹਨਾਂ ਦੀ ਭਾਸ਼ਾ ਦਾ ਥੋੜ੍ਹਾ ਬਹੁਤ ਗਿਆਨ ਹੋ ਗਿਆ ਜਿਵੇਂ ਕਿ ਅਸੀਂ ਪਿੱਛੇ ਪਿਛਲੇ ਸਾਲ ਕਰਨਾਟਕ ਗਏ ਸੀਗੇ ਔਰ ਕਰਨਾਟਕ ਅਸੀਂ ਦੇਖਿਆ ਕਿ ਉੱਥੋਂ ਦੇ ਲੋਕਾਂ ਦੀ ਜਿਹੜੀ ਭਾਸ਼ਾ ਸੀ ਉਹ ਬਿਲਕੁਲ ਵੱਖਰੀ ਸੀ ਸਾਨੂੰ ਉਹਨਾਂ ਦੀ ਭਾਸ਼ਾ ਦਾ ਕੁਛ ਸਮਝ ਨਹੀਂ ਸੀ ਆ ਰਿਹਾ ਪਰ ਅਸੀਂ ਦੇਖਿਆ ਕਿ ਜਦੋਂ ਉੱਥੇ ਉਹਨਾਂ ਨੇ ਕੋਈ ਬੋਰਡ ਲਗਾਏ ਸੀ ਅਤੇ ਨਾਲ ਅੰਗਰੇਜ਼ੀ ਵਿੱਚ ਵੀ ਕੁਛ ਲਿਖਿਆ ਸੀ ਤਾਂ ਸਾਨੂੰ ਸਮਝ ਆ ਜਾਂਦੀ ਸੀ ਕਿ ਇਹ ਕਿਸ ਤਰ੍ਹਾਂ ਦਾ ਲਿਖਿਆ ਹੋਇਆ ਹੈ ਅਤੇ ਇਹ ਕੀ ਕਹਿਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਦਾ ਸੱਭਿਆਚਾਰ ਵੀ ਬਿਲਕੁਲ ਸਾਡੇ ਸਭਿਆਚਾਰ ਨਾਲੋਂ ਵੱਖਰਾ ਸੀ ਅਤੇ ਸਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਅਸੀਂ ਇੱਕ ਵੱਖਰੀ ਸੱਭਿਆਚਾਰ ਵਾਲੀ ਧਰਤੀ 'ਤੇ ਆਏ ਹਾਂ ਜਾਂ ਵੱਖਰੇ ਲੋਕਾਂ ਨਾਲ ਸਾਡਾ ਮੇਲ ਜੋਲ ਹੋ ਰਿਹਾ ਆ ਸਾਡੇ ਨਾਲ ਕੁਛ ਇਹੋ ਜਿਹੇ ਵੀ ਲੋਕ ਸਨ ਜੋ ਉਹਨਾਂ ਦੀ ਭਾਸ਼ਾ ਜਾਣਦੇ ਸੀ ਫਿਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਅਸੀਂ ਉਹਨਾਂ ਨਾਲ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਦੇ ਸੀ ਤਾਂ ਉਹ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਦੇ ਸੀ ਪਰ ਜਿਹੜੇ ਸਾਡੇ ਨਾਲ ਗਏ ਸੀ ਉਹ ਸਾਨੂੰ ਬਾਅਦ ਵਿੱਚ ਦੱਸ ਦਿੰਦੇ ਸੀ ਕਿ ਇਹ ਕੀ ਕਹਿ ਰਹੇ ਨੇ ਅਤੇ ਉਹ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਸੀ ਅਤੇ ਇਸ ਤਰ੍ਹਾਂ ਅਸੀਂ ਉਹਨਾਂ ਨਾਲ ਆਪਸੀ ਗੱਲਬਾਤ ਵਾਰਤਾਲਾਪ ਜਿਹੜੀ ਆ ਉਹ ਜਾਰੀ ਰੱਖੀ ਅਤੇ ਉਹਨਾਂ ਦੇ ਸੱਭਿਆਚਾਰ ਤੋਂ ਵੀ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਦੀਆਂ ਪਰੰਪਰਾਵਾਦੀ ਉਹਨਾਂ ਦੇ ਕੱਪੜੇ ਜਿਹੜੇ ਸੀਗੇ ਉਹ ਵੀ ਸਾਨੂੰ ਬਹੁਤ ਵਧੀਆ ਲੱਗੇ ਧੰਨਵਾਦ